ਪਰਿਵਾਰਿਕ ਜ਼ਿੰਮੇਵਾਰੀਆਂ ਵੀ ਜ਼ਰੂਰੀ ਆ ਅਤੇ ਉਹਦੇ ਨਾਲ ਨਾਲ ਆਪਦੇ ਸ਼ੌਕ ਪੂਰੇ ਕਰਨੇ ਵੀ ਜ਼ਰੂਰੀ ਹੈ ਸ਼ੌਕ ਕੋਈ ਵੀ ਹੋ ਸਕਦਾ ਖੇਡਣ ਦਾ ਹੋ ਸਕਦਾ ਬਾਈਕਿੰਗ ਦਾ ਹੋ ਸਕਦਾ ਜਾਂ ਕਿਸੇ ਵੀ ਤਰ੍ਹਾਂ ਦਾ ਹੋ ਸਕਦਾ ਜਿਵੇਂ ਪਰਿਵਾਰਕ ਜ਼ਿੰਮੇਵਾਰੀਆਂ ਤਾਂ ਹਰੇਕ ਨੂੰ ਹੁੰਦੀਆਂ ਹੀ ਆ ਹਰੇਕ ਨੂੰ ਜ਼ਿੰਮੇਵਾਰੀਆਂ 'ਚੋਂ ਲੰਘਣਾ ਵੀ ਪੈਂਦਾ ਉਸ ਨੂੰ ਜਿਹੜਾ ਆਪਣਾ ਸ਼ੌਕ ਆ ਉਹਦੇ ਲਈ ਟਾਈਮ ਜ਼ਿੰਮੇਵਾਰੀਆਂ ਵਿੱਚੋਂ ਹੀ ਕੱਢਣਾ ਪੈਂਦਾ ਮੰਨ ਕੇ ਚਲੋ ਜਿਵੇਂ ਬਾਈਕਿੰਗ ਦਾ ਸ਼ੌਕ ਆ ਬਾਈਕਿੰਗ ਦੇ ਸ਼ੌਕ ਨੂੰ ਪੂਰਾ ਕਰਨ ਲਈ ਬੰਦਾ ਟਾਇਮ ਕੱਢੇ ਪਹਿਲਾਂ ਤਾਂ ਸਾਰੀ ਦਿਹਾੜੀ ਮੰਨ ਲਓ ਤੁਸੀਂ ਚਾਰ ਵਜੇ ਤੱਕ ਪੰਜ ਵਜੇ ਤੱਕ ਆਪਾਂ ਪਰਿਵਾਰਿਕ ਜ਼ਿੰਮੇਵਾਰੀਆਂ ਨਿਭਾ ਲਈਆਂ ਕੰਮ ਕਰ ਲਏ ਉਸ ਤੋਂ ਬਾਅਦ ਸ਼ਾਮ ਨੂੰ ਫਿਰ ਘੰਟੇ ਲਈ ਮੈਂ ਆਪਦਾ ਬਾਈਕ ਦਾ ਸ਼ੌਕ ਪੂਰਾ ਕਰਦਾ ਮੈਂ ਫਿਰ ਸ਼ਾਮ ਨੂੰ ਪੰਜ ਵਜੇ ਮੋਟਰਸਾਈਕਲ ਨੂੰ ਪਹਿਲਾਂ ਤਾਂ ਐਨ ਸਾਫ ਕਰ ਲੈਣਾ ਪੂਰਾ ਸਾਫ ਕਰਕੇ ਫਿਰ ਆਪਦੀ ਮਨ ਪਸੰਦ ਥਾਵਾਂ 'ਤੇ ਮੋਟਰਸਾਈਕਲ ਦੇ ਗੇੜੇ ਲਾਉਣੇ ਅਤੇ ਮੰਨ ਲਓ ਜੀ ਕਿਤੇ ਟੂਰ 'ਤੇ ਜਾਣਾ ਫਿਰ ਦੋ ਚਾਰ ਦੋਸਤ ਇਕੱਠੇ ਹੋ ਜਾਣਾ ਫਿਰ ਲੰਮੇ ਟੂਰ 'ਤੇ ਜਾਣਾ ਅਸੀ ਇਹਦੇ ਨਾਲ ਬਾਈਕਿੰਗ ਦਾ ਸ਼ੌਕ ਵੀ ਪੂਰਾ ਕਰ ਲਈਦਾ ਧੰਨਵਾਦ ਜੀ